ਸਾਡੇ ਪਿੰਡ ਵਿੱਚ ਲੋਕ ਪ੍ਰਸਿੱਧ ਨਾਚ ਹੈ ਗਿੱਧਾ ਅਤੇ ਭੰਗੜਾ ਵੱਖ ਵੱਖ ਤਰੀਕੇ ਦੇ ਅਵਸਰ 'ਤੇ ਜਿਵੇਂ ਕੀ ਵਿਆਹਾਂ 'ਤੇ ਜਾਗੋ 'ਤੇ ਅਤੇ ਵਿਸਾਖੀਆਂ ਵਾਲੇ ਦਿਨਾਂ 'ਤੇ ਸਾਰੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਗਿੱਧਾ ਅਤੇ ਭੰਗੜਾ ਪਾਉਂਦੇ ਹਨ ਕੁੜੀਆਂ ਬੋਲੀਆਂ ਪਾਉਂਦੀਆਂ ਹਨ ਅਤੇ ਸਾਰੇ ਰਲ ਮਿਲ ਕੇ ਨੱਚਦੇ ਹਨ ਸਾਰਿਆਂ ਨੂੰ ਤਿਉਹਾਰਾਂ ਦਾ ਬਹੁਤ ਮਜ਼ਾ ਆਉਂਦਾ ਹੈ ਕਿਉਂਕਿ ਲੋਕ ਨਾਚ ਹੀ ਇੱਕ ਇਹੋ ਜਿਹਾ ਨਾਚ ਹੈ ਜਿਹੜਾ ਸਾਰਿਆਂ ਨੂੰ ਇਕੱਠਾ ਕਰਨ ਵਿੱਚ ਕੰਮ ਆਉਂਦਾ ਹੈ